ਪਿਛਲੇ ਕੁਝ ਸਾਲਾਂ ਵਿੱਚ ਮਨੋਰੰਜਨ ਦੇ ਸਾਧਨਾਂ ਵਿੱਚ ਬਹੁਤ ਫਰਕ ਆਇਆ ਹੈ ਜਿਵੇਂ ਕਿ ਪਹਿਲਾਂ ਬਹੁਤ ਵੱਡੇ ਵੱਡੇ ਮੇਲੇ ਲੱਗਦੇ ਸੀ ਉੱਥੇ ਸਿੰਗਰ ਆਣ ਕੇ ਗਾਉਂਦੇ ਸੀ ਲੋਕ ਨੱਚਦੇ ਗਾਉਂਦੇ ਸੀ ਹਰ ਘਰ ਵਿੱਚ ਰੇਡੀਓ ਹੁੰਦੇ ਸਨ

ਫਿਰ ਕੰਪੂਟਰ ਆ ਗਏ ਸਮੇਂ ਸਮੇਂ ਨਾਲ ਮਨੋਰੰਜਨ ਦੇ ਸਾਧਨ ਬਦਲਦੇ ਗਏ ਹੁਣ ਸਭ ਦੇ ਕੋਲ ਮੋਬੈਲ ਆ ਗਏ ਹਨ ਹੁਣ ਮੋਬੈਲ ਹੀ ਸਭ ਲਈ ਮਨੋਰੰਜਨ ਦੇ ਸਾਧਨ ਬਣ ਗਏ